ਵੱਖ ਵੱਖ ਮੌਸਮ ਦੇ ਵਿੱਚ ਵੱਖ ਵੱਖ ਮਤਲਬ ਕਿ ਦੌੜਨ ਦੇ ਤਰੀਕੇ ਹੁੰਦੇ ਹਨ ਜਿਸ ਤਰ੍ਹਾਂ ਗਰਮੀ ਦੇ ਵਿੱਚ ਗਰਮ ਠੰਡਾ ਅਤੇ ਬਰਸਾਤ ਗਰਮੀ ਦੇ ਵਿੱਚ ਸਾਨੂੰ ਮਤਲਬ ਕਿ ਜਦੋਂ ਅਸੀਂ ਸੁਬਹਾ ਦੇ ਟਾਈਮ ਦੌੜਦੇ ਹਾਂ ਸੈਰ ਕਰਨ ਜਾਂਦੇ ਹਾਂ ਤਾਂ ਸਾਨੂੰ ਮਤਲਬ ਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਸੈਰ ਕਰਨ ਜਾਣਾ ਚਾਹੀਦਾ ਦੌੜਨਾ ਚਾਹੀਦਾ ਅਤੇ ਜੇਕਰ ਅਸੀਂ ਥੋੜੀ ਬਹੁਤੀ ਕੋਈ ਸਾਡੀ ਕਿਉਂਕਿ ਗਰਮੀ ਦੇ ਵਿੱਚ ਜੇਕਰ ਅਸੀਂ ਜਿਆਦਾ ਗਰਮੀ ਵਿੱਚ ਥੋੜਾ ਜਿਹਾ ਸੂਰਜ ਚੜਨ 'ਤੇ ਦੌੜਦੇ ਹਾਂ ਸਾਨੂੰ ਸਕਿਨ ਵਗੈਰਾ ਖਰਾਬ ਹੋ ਜਾਂਦੀ ਹੈ ਸਾਨੂੰ ਉਸ ਦੇ ਦੌਰਾਨ ਮਤਲਬ ਕਿ ਸਾਨੂੰ ਜਦੋਂ ਅਸੀਂ ਗਰਮੀ ਵਿੱਚ ਦੌੜਦੇ ਆ ਤਾਂ ਸਾਨੂੰ ਆਪਣੇ ਨਾਲ ਠੰਡੇ ਪਾਣੀ ਦੀ ਬੋਤਲ ਰੱਖਣੀ ਜ਼ਰੂਰੀ ਹੈ ਅਤੇ ਜੇਕਰ ਸਾਨੂੰ ਦੌੜਦੇ ਸਮੇਂ ਥੋੜਾ ਬਹੁਤਾ ਸਾਹ ਫੁੱਲਦਾ ਜਾਂ ਚੜਦਾ ਹੈ ਤਾਂ ਸਾਨੂੰ ਛਾਵੇਂ ਖੜ ਕੇ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਆ ਔਰ ਦੋ ਚਾਰ ਘੁੱਟਾਂ ਸਾਨੂੰ ਪਾਣੀ ਦੀਆਂ ਪੀ ਲੈਣੀਆਂ ਚਾਹੀਦੀਆਂ ਹਨ ਦੋ ਚਾਰ ਘੁੱਟਾਂ ਪਾਣੀ ਦੀਆਂ ਪੀ ਕੇ ਔਰ ਸਾਨੂੰ ਫੇਰ ਦੌੜਨਾ ਚਾਹੀਦਾ ਕੁਛ ਦੇਰ ਬਾਅਦ ਸਾਨੂੰ ਸਾਹ ਵੀ ਲੈਣ ਲੈ ਲੈਣਾ ਚਾਹੀਦਾ ਹੈ ਔਰ ਇਸ ਤੋਂ ਬਾਅਦ ਠੰਡ ਦੇ ਵਿੱਚ ਦੌੜਨ ਵਾਸਤੇ ਸਾਨੂੰ ਕੀ ਸੁਝਾਅ ਚਾਹੀਦਾ ਠੰਡ ਦੇ ਵਿੱਚ ਜਦੋਂ ਅਸੀਂ ਸੈਰ ਕਰਦੇ ਆਂ ਤੇ ਸਾਨੂੰ ਸਭ ਤੋਂ ਪਹਿਲਾਂ ਬੂਟ ਜਰਾਬਾਂ ਸਿਰ ਦੇ ਉੱਤੇ ਟੋਪੀ ਜਾਂ ਦਸਤਾਰ ਬੰਨਣੀ ਚਾਹੀਦੀ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਸਾਨੂੰ ਸਵੈਟਰ ਕੋਟੀ ਵਗੈਰਾ ਪਾਉਣੇ ਚਾਹੀਦੇ ਹਨ ਔਰ ਜਦੋਂ ਅਸੀਂ ਸਰਦੀ ਠੰਡ ਦੇ ਵਿੱਚ ਦੌੜਦੇ ਆਂ ਤੇ ਸਾਨੂੰ ਫੀਵਰ ਦੀ ਹੋਣ ਤੋਂ ਡਰ ਲੱਗਦਾ ਇਸ ਕਰਕੇ ਸਾਨੂੰ ਜਦੋਂ ਠੰਡ ਚ ਦੌੜਦੇ ਸਨ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਉਸ ਟਾਈਮ ਸਾਨੂੰ ਕੁਝ ਟਾਈਮ ਰੁਕ ਜਾਣਾ ਚਾਹੀਦਾ ਧੁੱਪ ਦੇ ਵਿੱਚ ਲੰਬੇ ਲੰਬੇ ਖੜ ਕੇ ਸਾਹ ਲੈਣੇ ਚਾਹੀਦੇ ਜਦੋਂ ਅਸੀਂ ਧੁੱਪ 'ਤੇ ਖੜ ਕੇ ਲੰਬੇ ਲੰਬੇ ਸਾਹ ਲਵਾਂਗੇ ਦੌੜ ਦੇ ਸਮੇਂ ਤੇ ਸਾਡੀ ਸਿਹਤ ਜਿਹੜੀ ਉਹ ਬਹੁਤ ਬਹੁਤ ਵਧੀਆ ਰਹੁੰਗੀ